ਮੈਨੂੰ ਕੁਕਿੰਗ ਕਰਨਾ ਬਹੁਤ ਹੀ ਪਸੰਦ ਹੈ ਮੈਂ ਛੋਟੀ ਹੁੰਦੀ ਤੋਂ ਹੀ ਕੁਕਿੰਗ ਕਰਦੀ ਆਈ ਹਾਂ ਮੇਰੇ ਘਰਦਿਆਂ ਨੂੰ ਮੇਰੇ ਹੱਥ ਦਾ ਖਾਣਾ ਬਹੁਤ ਹੀ ਪਸੰਦ ਆਉਂਦਾ ਹੈ ਮੇਰੇ ਘਰ ਜਦੋਂ ਵੀ ਕੋਈ ਰਿਸ਼ਤੇਦਾਰ ਆਉਂਦਾ ਹੈ ਤਾਂ ਉਹ ਮੇਰੇ ਖਾਣੇ ਦੀ ਬਹੁਤ ਹੀ ਸਿਫਤ ਕਰਦੇ ਹਨ ਮੈਂ ਸੈਂਟਰ ਵੀ ਜਾਂਦੀ ਹਾਂ ਤਾਂ ਉੱਥੇ ਵੀ ਮੇਰੇ ਕੋਲ ਖਾਣਾ ਬਣਵਾ ਲੈਂਦੇ ਹਨ ਤਾਂ ਉਹ ਵੀ ਮੇਰੇ ਖਾਣੇ ਦੀ ਬਹੁਤ ਹੀ ਸਿਫਤ ਕਰਦੇ ਹਨ ਮੈਂ ਸੈਂਟਰ ਕੱਪੜੇ ਸ ਕੱਪੜੇ ਸੀਂਦੀ ਹਾਂ ਤਾਂ ਉਹ ਵੀ ਕੱਪੜੇ ਮੇਰੇ ਮੈਂ ਬਹੁਤ ਹੀ ਵਧੀਆ ਸੀਂਦੀ ਹਾਂ ਤਾਂ ਆਂਢ ਗੁਆਂਢ ਸਾਰੇ ਹੀ ਮੈਤੋਂ ਹੀ ਕੱਪੜੇ ਸਵਾਉਂਦੇ ਹਨ ਉਹ ਮੇਰੀ ਬਹੁਤ ਹੀ ਸਿਫਤ ਕਰਦੇ ਹਾਂ ਜੇ ਮੈਂ ਗੱਲ ਕਰਾਂ ਆਪਣੀ ਕਮਜ਼ੋਰੀ ਦੀ ਤਾਂ ਮੈਨੂੰ ਗੁੱਸਾ ਬਹੁਤ ਹੀ ਛੇਤੀ ਆਉਂਦਾ ਹੈ ਮੈਂ ਵੱਧ ਤੋਂ ਵੱਧ ਕੋਸ਼ਿਸ਼ ਕਰਦੀ ਹਾਂ ਕਿ ਮੈਂ ਇਸ ਆਪਣੇ ਕਮਜ਼ੋਰੀ ਨੂੰ ਕਾਬੂ ਅਤੇ ਕੰਟਰੋਲ ਵਿੱਚ ਰੱਖਾਂ ਧੰਨਵਾਦ